ਕੈਮਰੇ ਨਾਲ ਤਸਵੀਰਾਂ ਹਰੇਕ ਬੰਦਾ ਆਪਣੇ ਆਪਣੇ ਸੁਭਾਅ ਜਾਂ ਆਪਣੇ ਕਿੱਤੇ ਦੇ ਹਿਸਾਬ ਨਾਲ ਵੀ ਖਿੱਚਦਾ ਹੈ ਜਿਸ ਤਰ੍ਹਾਂ ਮੈਂ ਪੱਤਰਕਾਰੀ ਦੇ ਖੇਤਰ ਨਾਲ ਜੁੜਿਆ ਹੋਇਆ ਹਾਂ ਮੇਰੀ ਭਾਲ ਹਰ ਸਮੇਂ ਇਸ ਤਰ੍ਹਾਂ ਦੇ ਦ੍ਰਿਸ਼ 'ਤੇ ਹੁੰਦੀ ਹੈ ਕਿ ਜਿਹੜਾ ਕੋਈ ਵੀ ਦ੍ਰਿਸ਼ ਵੱਖਰਾ ਹੋਵੇ ਮੈਂ ਉਹਨੂੰ ਆਪਣੇ ਕੈਮਰੇ ਵਿੱਚ ਕੈਦ ਕਰਨ ਲਈ ਹਰ ਸਮੇਂ ਤੱਤਪਰ ਰਹਿੰਦਾ ਹਾਂ ਜਾਂ ਕਈ ਵਾਰੀ ਕਈ ਇਸ ਤਰ੍ਹਾਂ ਦੀਆਂ ਅਣਹੋਣੀਆਂ ਘਟਨਾਵਾਂ ਕਈ ਵਾਰੀ ਅਚਾਨਕ ਹੁੰਦੀਆਂ ਹਨ ਤਾਂ ਉਹਨਾਂ ਦੀ ਅਸੀਂ ਮੂਵੀ ਵੀ ਬਣਾਉਂਦੇ ਹਾਂ ਫੋਟੋਆਂ ਵੀ ਖਿੱਚਦੇ ਹਾਂ ਜੋ ਕਿ ਲੋਕਾਂ ਤੱਕ ਜਦੋਂ ਸਾਡੇ ਮੀਡੀਆ ਵਿੱਚ ਛਪਦੀਆਂ ਹਨ ਤਾਂ ਉਹ ਚੰਗਾ ਪ੍ਰਭਾਵ ਪਾ ਸਕਣ ਹਰ ਵੇਲੇ ਦਿਨ ਹੋਵੇ ਰਾਤ ਹੋਵੇ ਗੱਡੀ ਚਲਾਉਂਦੇ ਹੋਈਏ ਜਾਂ ਆਪਣੇ ਖੇਤਾਂ ਵਿੱਚ ਜਾਂਦੇ ਹੋਈਏ ਜਾਂ ਆਪਣਾ ਕੋਈ ਹੋਰ ਕੰਮ ਕਰਦੇ ਹੋਈਏ ਜਿਸ ਤਰ੍ਹਾਂ ਹੁਣ ਸਾਇੰਸ ਦੀ ਸਾਇੰਸ ਦਾ ਜਿਹੜਾ ਬਹੁਤ ਵਾਧਾ ਹੋ ਗਿਆ ਹੈ ਤਾਂ ਪਹਿਲਾਂ ਸਾਨੂੰ ਕੈਮਰੇ ਟੋਹਲਣੇ ਪੈਂਦੇ ਸਨ ਰੱਖਣੇ ਪੈਂਦੇ ਸਨ ਕੋਲ ਉਹਨਾਂ ਦਾ ਰੱਖ ਰਖਾਵ ਕਰਨਾ ਬਹੁਤ ਔਖਾ ਹੁੰਦਾ ਸੀ ਹੁਣ ਸਾਇੰਸ ਦੀ ਤਰੱਕੀ ਕਾਰਨ ਮੋਬੈਲ ਹੀ ਇੱਦਾਂ ਦੇ ਚੱਲ ਪਏ ਹਨ ਕਿ ਜਿਹੜੇ ਬਹੁਤ ਹੀ ਡਿਜ਼ੀਟਲ ਹਨ ਹਰ ਟਾਈਮ ਅਸੀਂ ਪਾਸ ਵੀ ਰੱਖ ਸਕਦੇ ਹਾਂ ਕਿਸੇ ਵੀ ਸਮੇਂ ਜਾਈਦਾ ਸਾਡੇ ਕੋਲ ਹੁੰਦੇ ਹੈ ਜਦੋਂ ਵੀ ਅਸੀਂ ਕਿਸੇ ਵੀ ਖੇਤਰ ਵਿੱਚ ਲੰਘਦੇ ਹਾਂ ਜਾਂ ਕੁਛ ਆਲਾ ਦੁਆਲਾ ਕੁਛ ਨਵਾਂ ਦੇਖਦੇ ਹਾਂ ਤਾਂ ਅਸੀਂ ਉਸ ਨੂੰ ਕੈਚ ਕਰਨ ਦਾ ਯਤਨ ਕਰਦੇ ਹਾਂ ਤਾਂ ਜੋ ਉਹ ਲੋਕਾਂ ਤੱਕ ਅਸੀਂ ਪਜਾ ਸਕੀਏ ਜਿਸ ਨਾਲ ਸਾਰਾ ਕੁਝ ਦੁਨੀਆ ਨੂੰ ਦਿਖਾਇਆ ਜਾ ਸਕੇ ਕੈਮਰਾ ਇੱਕ ਅਜਿਹੀ ਚੀਜ਼ ਆ ਜਿਸ ਨਾਲ ਅਸੀਂ ਆਲੇ ਦੁਆਲੇ ਦਾ ਜੋ ਵੀ ਹੈਗਾ ਹੈ ਉਹ ਸ਼ੀਸ਼ਾ ਦੁਨੀਆ ਤੱਕ ਆਸਾਨੀ ਨਾਲ ਪਹੁੰਚਾ ਸਕਦੇ ਹਾਂ